ਮੈਨੂੰ ਵੈਸੇ ਤਾਂ ਖਾਣਾ ਬਣਾਉਣਾ ਨਹੀਂ ਆਉਂਦਾ ਬਟ ਇੱਕ ਦਿਨ ਕੀ ਹੋਇਆ ਕਿ ਸਾਡੇ ਘਰ ਜੋ ਮੰਮਾ ਸੀਗੇ ਉਹ ਕਿਤੇ ਬਾਹਰ ਮਾਰਕੀਟ ਗਏ ਹੋਏ ਸੀਗੇ ਅਤੇ ਘਰ ਵਿੱਚ ਮੈਂ ਅਤੇ ਮੇਰੀ ਛੋਟੇ ਰਿਸਿਸਟ ਛੋਟੀ ਸਿਸਟਰ ਹੀ ਸੀਗੇ ਅਤੇ ਸਾਡੇ ਅਚਾਨਕ ਹੀ ਗੈਸਟ ਆ ਗਏ ਅਤੇ ਉਹਨਾਂ ਲਈ ਲੰਚ ਤਿਆਰ ਕਰਨਾ ਸੀਗਾ ਸੋ ਮੈਂ ਯੂਟਿਊਬ ਦੇ ਉੱਪਰ ਦੇਖ ਕੇ ਰੈਸਪੀ ਜੋ ਮਟਰ ਪਨੀਰ ਦੀ ਸੀਗੀ ਉਹ ਤਿਆਰ ਕਰ ਰਹੀ ਸੀਗੀ ਮੈਂ ਮਟਰ ਪਨੀਰ ਦੀ ਪੂਰੀ ਰੈਸਪੀ ਦੇਖ ਕੇ ਸਬਜ਼ੀ ਪੂਰੀ ਜੋ ਹੈ ਤਿਆਰ ਕਰ ਲਈ ਸੀ ਬਟ ਹੋਇਆ ਕੀ ਕਿ ਜਦੋਂ ਉਸਨੂੰ ਮੈਂ ਟੇਸਟ ਕੀਤਾ ਕਿ ਉਹਦੇ ਵਿੱਚ ਥੋੜ੍ਹੀ ਜੋ ਖਟਾਸ ਸੀਗੀ ਉਹ ਥੋੜ੍ਹੀ ਜ਼ਿਆਦਾ ਸੀਗੀ ਸੋ ਜੋ ਟੇਸਟ ਉਹ ਅੱਛਾ ਨਹੀਂ ਲੱਗ ਰਿਹਾ ਸੀਗਾ ਫਿਰ ਮੈਂ ਸੋਚਿਆ ਅਗਰ ਜੇ ਮੈਂ ਦੁਬਾਰਾ ਇਹੀ ਬਣਾਵਾਂਗੀ ਅਤੇ ਇਹ ਵਾਲਾ ਬਰਬਾਦ ਹੋ ਜਾਏਗਾ ਸੋ ਮੈਂ ਮੈਂ ਟਰਾਏ ਮੈਂ ਸੋਚਿਆ ਕਿ ਕੁਛ ਹੋਰ ਟਰਾਏ ਕਰਕੇ ਦੇਖਦੀ ਹਾਂ ਅਤੇ ਮੈਂ ਜੋ ਹੈ ਇਸ ਵਿੱਚ ਉਸੇ ਸਬਜ਼ੀ ਦੇ ਵਿੱਚ ਜੋ ਹੈ ਥੋੜ੍ਹੀ ਜਿਹੀ ਮਲਾਈ ਐਡ ਕਰਤੀ ਅਤੇ ਕੁਛ ਪਨੀਰ ਦੇ ਪੀਸਸ ਹੋਰ ਐਡ ਕਰ ਦਿੱਤੇ ਅਤੇ ਉਸ ਤੋਂ ਬਾਅਦ ਜੋ ਟੇਸਟ ਕੀਤਾ ਗਿਆ ਅਤੇ ਉਹ ਟੇਸਟ ਮਤਲਬ ਕਾਫੀ ਅੱਛਾ ਸੀਗਾ ਉਸ ਤੋਂ ਬਾਅਦ ਮੈਂ ਉਹ ਸਬਜ਼ੀ ਅਤੇ ਉਸਦੇ ਨਾਲ ਕੁਛ ਫੁਲਕੇ ਪਾ ਕੇ ਅਤੇ ਸਲਾਦ ਦੇ ਨਾਲ ਮੈਂ ਆਪਣੇ ਜੋ ਗੈਸਟ ਸੀਗੇ ਉਹਨਾਂ ਨੂੰ ਸਰਵ ਕੀਤਾ ਅਤੇ ਉਹਨਾਂ ਨੇ ਜੋ ਖਾਧਾ ਅਤੇ ਉਹਨਾਂ ਨੂੰ ਕਾਫੀ ਅੱਛਾ ਲੱਗਾ ਥੈਂਕ ਯੂ